ਸਾਡੇ ਸਥਾਨ ਦੇ ਮੁੱਲ ਕਲਾ ਰੂਪ ਬਹੁਤ ਸਾਰੇ ਹਨ ਅਤੇ ਇਲਾਕੇ ਵਿੱਚ ਹੀ ਸਾਰਾ ਸਮਾਨ ਆਪ ਹੀ ਤਿਆਰ ਕੀਤਾ ਜਾਂਦਾ ਹੈ ਕੋਈ ਵੀ ਤਿਉਹਾਰ ਜਾਂ ਪ੍ਰੋਗਰਾਮ ਲਈ ਇਲਾਕੇ ਵਿੱਚੋਂ ਹੀ ਤਿਆਰ ਕੀਤਾ ਸਮਾਨ ਵਰਤਿਆ ਜਾਂਦਾ ਹੈ ਸਾਡੇ ਇਲਾਕੇ ਵਿੱਚ ਮੂਰਤੀਆਂ ਪੁਤਲੇ ਪੇਂਟਿੰਗ ਆਦਿ ਸਭ ਕੁਝ ਬਣਾਇਆ ਜਾਂਦਾ ਹੈ ਸਾਡੇ ਇਲਾਕੇ ਨੂੰ ਹੋਰ ਸਥਾਨਾਂ ਤੋਂ ਇਹ ਵੱਖਰਾ ਬਣਾਉਂਦੀ ਹੈ ਕਿ ਸਾਡੇ ਇਕੱਲੇ ਸਮਾਨ ਵਿੱਚ ਬਣੀਆਂ ਮੂਰਤੀਆਂ ਪੁਤਲੇ ਜਾਂ ਪੇਟਿੰਗ ਆਦਿ ਨੂੰ ਪੂਰੇ ਪੰਜਾਬ ਵਿੱਚ ਵੀ ਡਿਲੀਵਰ ਕੀਤਾ ਜਾਂਦਾ ਹੈ ਅਤੇ ਲੋਕ ਪੰਜਾਬ ਦੇ ਬਾਹਰੋਂ ਵੀ ਮੰਗਵਾਉਂਦੇ ਹਨ ਅਤੇ ਸਿਫਤਾਂ ਕਰਦੇ ਹਨ